ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੇਰੇ ਹਿਸਾਬ ਨਾਲ ਸਾਨੂੰ ਸਾਰੇ ਹੀ ਜਣਿਆਂ ਨੂੰ ਆਪਣੇ ਵਿਹੜੇ ਜਾਂ ਜਿਹੜਾ ਬਾਹਰਲਾ ਵਰਾਂਡਾ ਹੁੰਦਾ ਵਾ ਉੱਥੇ ਪੰਛੀਆਂ ਦੇ ਆਉਣ ਦੇ ਲਈ ਸਾਨੂੰ ਉਹਨਾਂ ਦੇ ਲਈ ਕੋਈ ਇਹੋ ਜਿਹਾ ਪ੍ਰਬੰਧ ਕਰਨਾ ਚਾਹੀਦਾ ਵਾ ਤਾਂ ਕਿ ਉਹ ਆ ਕੇ ਆਪਣਾ ਜਿਹੜਾ ਵਾ ਜੋ ਵੀ ਉਹਨਾਂ ਦਾ ਖਾਣ ਦੇ ਲਈ ਉਹਨਾਂ ਨੂੰ ਚਾਹੀਦਾ ਹੁੰਦਾ ਵਾ ਉਹ ਉਹਨਾਂ ਨੂੰ ਮਿਲ ਸਕੇ ਉਹਦੇ ਲਈ ਸਾਨੂੰ ਉਹਨਾਂ ਦੇ ਲਈ ਚੋਗਾ ਪਾਉਣਾ ਚਾਹੀਦਾ ਵਾ ਅਤੇ ਨਾਲ ਹੀ ਪਾਣੀ ਦਾ ਜਿਹੜਾ ਵਾ ਉਹ ਇੱਕ ਜਿਹੜਾ ਵਾ ਛੋਟੀ ਜਿਹੀ ਛੋਟੀ ਜਿਹੀ ਟਿਸੀ ਬਰਤਨ ਦੇ ਵਿੱਚ ਪਾ ਲਓ ਤੁਸੀਂ ਪਾਣੀ ਦਾ ਇੱਕ ਪਿਆਲਾ ਉਹਨਾਂ ਦੇ ਲਈ ਰੱਖ ਸਕਦੇ ਹੋ ਤਾਂ ਕਿ ਜਿਹੜੇ ਪੰਛੀ ਇੱਧਰੋਂ ਉੱਧਰੋਂ ਦੂਰੋਂ ਕਿਤੇ ਆਉਂਦੇ ਆ ਕਿਤੇ ਉਹ ਇੱਥੇ ਤੁਹਾਡੇ ਵਿਹੜੇ ਵਿੱਚ ਆਉਣਗੇ ਕਿਤੇ ਇੱਥੇ ਘੜੀ ਕੁ ਪਾਣੀ ਪੀ ਕੇ ਅਤੇ ਤੁਹਾਡਾ ਆਪਾਂ ਤੁਹਾਡਾ ਜਿਹੜਾ ਵਾ ਉਹ ਸ਼ੁਕਰ ਕਰਨਗੇ ਵੀ ਜਦੋਂ ਸਾਨੂੰ ਪਾਣੀ ਪੀਣ ਨੂੰ ਮਿਲਿਆ ਵਾ ਬਾਕੀ ਜਿਹੜਾ ਵਾ ਇਹ ਸੁਝਾਅ ਦੀ ਗੱਲ ਕਰਦੇ ਜੇ ਬੱਚਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਸੁਝਾਅ ਦੇ ਲਈ ਇਹਦੇ ਵਿੱਚ ਇੱਕ ਮੈਂ ਐਡ ਅਪ ਕਰਨਾ ਚਾਹਾਂਗਾ ਵੀ ਸਾਨੂੰ ਉਹਨਾਂ ਦੇ ਲਈ ਇੱਕ ਬੀਜੜਾ ਬਣਾਉਣਾ ਚਾਹੀਦਾ ਵਾ ਇੱਕ ਜਿਹਦੇ ਵਿੱਚ ਪੰਛੀ ਜਿਹੜੇ ਆ ਆ ਕੇ ਜਿਹੜੇ ਆ ਉਹ ਆਰਾਮ ਕਰ ਸਕਦੇ ਆ ਇੱਕ ਆਲ੍ਹਣਾ ਕਹਿੰਦੇ ਆ ਜਿਹਨੂੰ ਪੰਛੀਆਂ ਦੇ ਲਈ ਇੱਕ ਆਰਟੀਫਿਸ਼ਲ ਆਲ੍ਹਣਾ ਵੀ ਆਉਂਦਾ ਵਾ ਜਿਹਦੇ ਵਿੱਚ ਪੰਛੀ ਜਿਹੜੇ ਆ ਓਹ ਜਸਟ ਬਿਲਕੁਲ ਉਸੇ ਤਰ੍ਹਾਂ ਦਾ ਆਲ੍ਹਣਾ ਹੁੰਦਾ ਵਾ ਜਿਸ ਤਰ੍ਹਾਂ ਦਾ ਪੰਛੀਆਂ ਨੇ ਆਪਣਾ ਆਲ੍ਹਣਾ ਬਣਾਇਆ ਹੁੰਦਾ ਵਾ ਬੀਜੜਾ ਜਿਹਨੂੰ ਕਹਿੰਦੇ ਆ ਅਸੀਂ ਪੰਜਾਬੀ ਦੇ ਵਿੱਚ ਉਹ ਉਸੇ ਤਰ੍ਹਾਂ ਦਾ ਆਲ੍ਹਣਾ ਆਪਾਂ ਜਿਹੜਾ ਵਾ ਉਹ ਹੁਣ ਪੰਛੀਆਂ ਦੇ ਲਈ ਬਣਾ ਸਕਦੇ ਐ ਜਿਹੜੇ ਕਿ ਪ੍ਰਵਾਸੀ ਪੰਛੀ ਹੁੰਦੇ ਆ ਉਹ ਉਹ ਵੀ ਜੇਕਰ ਇੱਥੇ ਆਉਣਗੇ ਅਤੇ ਉਹ ਆਪਣੇ ਆਲ੍ਹਣੇ ਦੇ ਵਿੱਚ ਆ ਕੇ ਇੱਥੇ ਆਰਾਮ ਕਰ ਸਕਦੇ ਜੇਕਰ ਇਹੋ ਜਿਹਾ ਕੋਈ ਵੀ ਜਿਹੜਾ ਵਾ ਆਪਾਂ ਸਟੈਪ ਲੈਂਦੇ ਹਾਂ ਉੱਥੇ ਉਹ ਪੰਛੀਆਂ ਦੇ ਲਈ ਮੇਰੇ ਹਿਸਾਬ ਨਾਲ ਬਹੁਤ ਹੀ ਜਿਹੜਾ ਵਾ ਉਹ ਵਧੀਆ ਅਤੇ ਕਾਰਜਕਾਰੀ ਸਟੈਪ ਜਿਹੜਾ ਵਾ ਉਹ ਲਿਆ ਗਿਆ ਮੰਨਿਆ ਜਾਏਗਾ ਮੈ